ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਅ ਜੀ ਮੈਂ ਦਿੱਲੀ ਤੋਂ ਗੱਲ ਕਰ ਰਿਹਾ ਹਾਂ ਹਾਂਜੀ ਤੁ ਤੁਸੀਂ ਪੰਜਾਬ 'ਚ ਪ੍ਰਸਿੱਧ ਜਗ੍ਹਾ ਦੱਸ ਸਕਦੇ ਮੈਨੂੰ ਘੁੰਮਣ ਵਾਸਤੇ ਟੁਰੇਸਟ ਵਾਸਤੇ ਹਾਂ ਹਾਂਜੀ ਭਾਅ ਜੀ ਆਪਣਾ ਅੰਬਰ ਆਪਣਾ ਅੰਬਰਸਰ ਉੱਥੇ ਕੀ ਹੈ ਭਾਅ ਜੀ ਅੱਛਾ ਜੀ ਅਤੇ ਹੋਰ ਕੀ ਹੈ ਉੱਥੇ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਅਤੇ ਆਪਣਾ ਅਨੰਦਪੁਰ ਸਾਹਿਬ ਅੱਛਾ ਜੀ ਅੱਛਾ ਜੀ ਅੱਛਾ ਜੀ ਅਤੇ ਤੁਸੀਂ ਮੈਨੂੰ ਖਰਚਾ ਦੱਸ ਸਕਦੇ ਹੋ ਜੇ ਅਗਰ ਇਹਨਾਂ ਦੋਨਾਂ ਜਗ੍ਹਾ 'ਤੇ ਘੁੰਮਣਾ ਹੋਵੇ ਕਿੰਨਾ ਕੁ ਖਰਚਾ ਆ ਜਾਵੇਗਾ ਦੋਨੇ ਜਗ੍ਹਾ ਦਾ ਜੀ ਅਤੇ ਅਗਰ ਇੱਕ ਜਗ੍ਹਾ ਜਾਣਾ ਹੋਵੇ ਮੰਨ ਲਉ ਆਪਾਂ ਨੇ ਇਕੱਲਾ ਅੰਮ੍ਰਿਤਸਰ ਹੀ ਜਾਣਾ ਹੈ ਅੱਛਾ ਜੇ ਜਿਸ 'ਚ ਗੱਡੀ ਤੁਹਾਡੀ ਹੋਵੇਗੀ ਅਤੇ ਡਰਾਈਵਰ ਵੀ ਅੱਛਾ ਰੋਟੀ ਪਾਣੀ ਵੀ ਤੁਹਾਡਾ ਹੋਵੇਗਾ ਰਹਿਣ ਸਹਿਣ ਦਾ ਵੀ ਅੱਛਾ ਰਹਿਣ ਸਹਿਣ ਦਾ ਸਾਡਾ ਖਰਚਾ ਹੋਵੇਗਾ ਜੀ ਠੀਕ ਹੈ ਜੀ ਚਲੋ ਠੀਕ ਹੈ ਭਾਅ ਜੀ ਫਿਰ ਮੈ ਤੁਹਾਨੂੰ ਕੋਲ ਕਰਕੇ ਦੱਸ ਦੇਵਾਂਗਾ ਓਕੇ ਥੈਂਕ ਯੂ ਜੀ